ਭਾਰਤ ਦੇ ਵਿੱਚ ਮੇਰਾ ਮਨਪਸੰਦ ਜਿਹੜਾ ਰਾਜ ਜਿਹੜਾ ਹੈ ਉਹ ਹੈ ਯੂ ਪੀ ਹੈ ਯੂ ਪੀ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈਗੀ ਹੈ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈਗੀ ਹੈ ਮਥੁਰਾ ਔਰ ਮਥੁਰਾ ਵੀ ਘੁੰਮਣ ਵਾਲਾ ਹੈ ਔਰ ਮੈਂ ਵ੍ਰਿੰਦਾਵਨ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਬਹੁਤ ਸਾਰੇ ਮੰਦਰਾਂ ਦੇ ਦਰਸ਼ਨ ਕੀਤੇ ਨੇ ਅਤੇ ਮੰਦਰਾਂ 'ਚ ਮੈਨੂੰ ਬਹੁਤ ਆਨੰਦ ਆਇਆ ਮੈਂ ਇੱਕ ਵਾਰੀ ਆਪਣੇ ਮੈਂ ਇੱਕ ਵਾਰੀ ਆਪਣੇ ਕਿਸੇ ਫਰੈਂਡ ਦੇ ਨਾਲ ਵ੍ਰਿੰਦਾਵਨ ਘੁੰਮਣ ਗਿਆ ਸੀ ਹੋਲੀਆਂ ਦੇ ਦਿਨਾਂ ਦੇ ਵਿੱਚ ਸਾਨੂੰ ਤਿੰਨ ਦਿਨ ਦੀ ਬਾਜ਼ਾਰਾਂ ਦੇ ਵਿੱਚ ਛੁੱਟੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਵ੍ਰਿੰਦਾ ਵਨ ਚਲੇ ਗਏ ਉੱਥੇ ਜਾ ਕੇ ਪਹਿਲੇ ਅਸੀਂ ਬਰਸਾਨੇ ਦੇ ਵਿੱਚ ਗਏ ਫਿਰ ਬਰਸਾਨੇ ਤੋਂ ਬਾਅਦ ਅਸੀਂ ਗੋਵਰਧਨ ਪਰਬਤ ਦੀ ਪਰਿਕਰਮਾ ਲਾਈ ਫਿਰ ਅਸੀਂ ਉੱਥੇ ਕੀ ਕਹਿੰਦੇ ਆ ਵ੍ਰਿੰਦਾਵਨ ਵਿੱਚ ਆ ਗਏ ਔਰ ਵ੍ਰਿੰਦਾਵਨ ਵਿੱਚ ਅਸੀਂ ਵੇਖਿਆ ਉੱਥੇ ਫੁੱਲ ਹੋਲੀ ਖੇਡੀ ਜਾਂਦੀ ਹੈ ਮੰਦਰਾਂ ਦੇ ਵਿੱਚ ਉਹ ਫੁੱਲ ਹੋਲੀ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ ਔਰ ਹੋਲੀ ਵਾਲੇ ਦਿਨ ਉੱਥੇ ਬਹੁਤ ਹੀ ਵਧੀਆ ਫੁੱਲ ਹੋਲੀ ਖੇਡੀ ਜਾਂਦੀ ਹੈ ਔਰ ਹੋਲੀ ਦਾ ਉਸ ਤੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉੱਥੇ ਹੋਲੀ ਦੇ ਦਿਨਾਂ ਦੇ ਵਿੱਚ ਬਾਜ਼ਾਰ ਅੱਧੇ ਦਿਨ ਵਾਸਤੇ ਬੰਦ ਰਹਿੰਦੇ ਨੇ ਫਿਰ ਸ਼ਾਮ ਨੂੰ ਬਾਜ਼ਾਰ ਖੁੱਲ ਜਾਂਦੇ ਨੇ ਔਰ ਮੰਦਰ ਬੜੀ ਫੁੱਲਾਂ ਦੀ ਸਜਾਵਟ ਨਾਲ ਸਜਾਏ ਜਾਂਦੇ ਨੇ ਉਹ ਮੰਦਰਾਂ ਦੇ ਵਿੱਚ ਸਜਾਵਟ ਬਹੁਤ ਵਧੀਆ ਹੋਈ ਹੁੰਦੀ ਹੈ ਔਰ ਉੱਥੇ ਹੋਰ ਮੈਂ ਚਾਹਵਾਂਗਾ ਯੂ ਪੀ ਦੇ ਵਿੱਚ ਪਰ ਭਗਵਾਨ ਰਾਮ ਦਾ ਜਿਹੜਾ ਅਯੋਧਿਆ ਦਾ ਮੰਦਰ ਬਣਿਆ ਹੈ ਉਹ ਮੈਂ ਜ਼ਰੂਰ ਵੇਖਣਾ ਚਾਵਾਂਗਾ ਔਰ ਕਾਸ਼ੀ ਦੇ ਯੂ ਪੀ ਦੇ ਵਿੱਚ ਕਾਸ਼ੀ ਸ਼ਿਵਜੀ ਜੀ ਦਾ ਧਾਮ ਹੈ ਸ਼ਿਵ ਸ਼ੰਕਰ ਜੀ ਦਾ ਧਾਮ ਹੈ ਉਹ ਵੀ ਜ਼ਰੂਰ ਦੇਖਣਾ ਚਾਹਵਾਂਗਾ ਭਗਵਾਨ ਸ਼ੰਕਰ ਜੀ ਦਾ ਧਾਮ ਦੇਖਣ ਵਾਲਾ ਹੈ ਅਯੋਧਿਆ ਦਾ ਤਾਂ ਮੰਦਰ ਦੇਖਣ ਵਾਲਾ ਹੈ ਅਯੋਧਿਆ ਦੇ ਵਿੱਚ ਜਿਹੜੀ ਮੂਰਤੀ ਹੈ ਉਹ ਬਹੁਤ ਹੀ ਅੱਛੀ ਬਣਾਈ ਗਈ ਹੈ ਉਹਨੂੰ ਦੇਖ ਕੇ ਇਉਂ ਲੱਗਦਾ ਹੈ ਸ਼ਾਕ ਸ਼ਾਤ ਭਗਵਾਨ ਰਾਮ ਸਾਡੇ ਨਾਲ ਮਤਲਬ ਕਿ ਸਾਨੂੰ ਦੇਖ ਰਹੇ ਹਨ ਔਰ ਮੰਦਰ ਜਿਹੜਾ ਹੈ ਬਹੁਤ ਵਧੀਆ ਬਣਾਇਆ ਗਿਆ ਹੈ ਔਰ ਹੁਣ ਸੁਣਨ 'ਚ ਆ ਰਿਹਾ ਹੈ ਕਾਫ਼ੀ ਲੋਕ ਉੱਥੇ ਮੰਦਰ ਦੇ ਵਿੱਚ ਦਰਸ਼ਨ ਕਰਨ ਆ ਰਹੇ ਹਨ ਔਰ ਮੰਦਰ ਇਹੋ ਜਿਹਾ ਮੰਦਰ ਪੂਰੇ ਇੰਡੀਆ ਦੇ ਵਿੱਚ ਹਾਲੇ ਦੇਖਣ ਨੂੰ ਨਹੀਂ ਮਿਲਿਆ